ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਲੋਕਲ ਪਹਿਰਾਵੇ ਜਿਵੇਂ ਕਿ ਕੁੜਤੀਆਂ ਚੂੜੀਦਾਰ ਅਤੇ ਸੱਜ ਤੇ ਪਹਿਨੇ ਜਾਂਦੇ ਹਨ ਇਹ ਪੁਸ਼ਾਕਾਂ ਰੰਗੀਨ ਅਤੇ ਚਮਕਦਾਰ ਹੁੰਦੀਆਂ ਹਨ ਜੋ ਡਾਂਸ ਕਰਨ ਵਾਲਿਆਂ ਨੂੰ ਹੋਰ ਆਕਰਸ਼ਕ ਬਣਾਉਣ ਦੀਆਂ ਹਨ ਇਹਨਾਂ ਦੇ ਨਕਸ਼ੇ ਸਜਾਵਟ ਡਾਂਸ ਦੇ ਮੂੜ ਨੂੰ ਪ੍ਰਕਾਸ਼ਿਤ ਕਰਦੇ ਹਨ ਚੱਲਣ ਫਿਰਨ ਦੇ ਦੌਰਾਨ ਢੰਗ ਅਤੇ ਲਹਿਰਾਂ ਨੂੰ ਵਧਾਉਂਦੇ ਹਨ ਇਸ ਨਾਲ ਸਾਥ ਹੀ ਇਸ ਦੇ ਖੇਤਰ ਦੀ ਸੰਸਕ੍ਰਿਤੀ ਅਤੇ ਵਿਰਾਸਤ ਬਾਰੇ ਪਤਾ ਲੱਗਦਾ ਹੈ ਜਦੋਂ ਇਹ ਪਹਿਰਾਵਾ ਪਹਿਨਦੇ ਹਨ ਤਾਂ ਦਿਲਾਂ ਨੂੰ ਬਹੁਤ ਚੰਗਾ ਲੱਗਦਾ ਹੈ ਜਦੋਂ ਇਹ ਪਹਿਰਾਵਾ ਪਹਿਨ ਕੇ ਆਉਂਦੇ ਹਨ ਤਾਂ ਪੂਰੇ ਪੰਜਾਬ ਦੀ ਝਲਕ ਮਹਿਸੂਸ ਹੁੰਦੀ ਹੈ ਕੁੜੀਆਂ ਦੇ ਵਿੱਚ ਘੱਗਰੇ ਚੋਲੀ ਅਤੇ ਪਜਾਮਾ ਕੁੜਤਾ ਮੁੰਡੇ ਪਾਉਂਦੇ ਹਨ ਮੁੰਡੇ ਚਾਦਰਾ ਕੁੜਤਾ ਪਾਉਂਦੇ ਹਨ ਅਤੇ ਨਾਲ ਹੀ ਪੱਗਾਂ ਬੰਨਦੇ ਹਨ ਤੁਰਲੇ ਵਾਲੀਆਂ ਪੱਗਾਂ ਬੰਨੀਆਂ ਹੁੰਦੀਆਂ ਨੇ ਜਿਸ ਦੇ ਨਾਲ ਉਹ ਬਹੁਤ ਹੀ ਸੋਹਣੇ ਲੱਗਦੇ ਹਨ ਸਾਡੀ ਮੈਰਿਜ ਦੇ ਵਿੱਚ ਜਾਗੋ ਦਾ ਪ੍ਰੋਗਰਾਮ ਸੀ ਅਸੀਂ ਬਹੁਤ ਸਾਰੇ ਭੰਗੜੇ ਵਾਲੇ ਮੁੰਡੇ ਬੁਲਾ ਬੁਲਾਏ ਜਿਹਨਾਂ ਨੇ ਪੱਗਾਂ ਬੰਨੀਆਂ ਹੋਈਆਂ ਸੀ ਕੈਂਠੇ ਪਾਏ ਹੋਏ ਸੀ ਅਤੇ ਜੁੱਤੀਆਂ ਤਿੱਲੇਦਾਰ ਜੁੱਤੀਆਂ ਪਾਈਆਂ ਹੋਈਆਂ ਸੀ ਸਾਨੂੰ ਬਹੁਤ ਹੀ ਸੋਹਣੇ ਲੱਗੇ ਪਹਿਰਾਵੇ ਦੇ ਤੱਤ ਕਰਤੀਆ ਇਹ ਆਮ ਤੌਰ 'ਤੇ ਰੰਗੀਨ ਚਮਕਦਾਰ ਹੁੰਦੀਆਂ ਹਨ ਜੋ ਡਾਂਸ ਦੇ ਦੌਰਾਨ ਚਮਕਦਾਰ ਲੱਗਦੀਆਂ ਹਨ ਇਹਨਾਂ 'ਚ ਲਾਈਟ ਫੈਬਰਿਕ ਵਰਤਿਆ ਜਾਂਦਾ ਹੈ ਚੂੜੀਦਾਰ ਇਹ ਪਹਿਰਾਵੇ ਪੈਰਾਂ ਦੀ ਆਜ਼ਾਦੀ ਨੂੰ ਯਕੀਨੀ ਬਣਾਉਂਦੇ ਹਨ ਜਿਸ ਨਾਲ ਡਾਂਸ ਅਤੇ ਕਦਮ ਬਹੁਤ ਸੁਗਮ ਲੱਗਦੇ ਹਨ ਰੰਗਾਂ ਦਾ ਮਹੱਤਵ ਵੀ ਭੰਗੜੇ ਵਿੱਚ ਬਹੁਤ ਹੁੰਦਾ ਹੈ ਗੂੜੇ ਰੰਗਾਂ ਵਾਲੇ ਕੱਪੜੇ ਉਹ ਭੰਗੜੇ ਵਾਲਿਆਂ ਨੂੰ ਬਹੁਤ ਜੱਚਦੇ ਹਨ ਜਿਸ ਦੇ ਨਾਲ ਉਹਨਾਂ ਦਾ ਜਿਹੜਾ ਪਹਿਰਾਵਾ ਹੈ ਉਹ ਸੁੰਦਰਤਾ ਦੇ ਨਾਲ ਭਰ ਜਾਂਦਾ ਹੈ ਉਹ ਆਕਰਸ਼ਕ ਲੱਗਦੇ ਹਨ ਭੰਗੜੇ ਦੇ ਸਟਾਇਲ ਸਜਾਵਟ ਨਾਲ ਡਾਂਸ ਕਰਨ ਵਾਲੇ ਹੋਰ ਆਕਰਸ਼ਕ ਮਨਮੋਹਕ ਬਣ ਜਾਂਦੇ ਹਨ ਚਮਕੀਲੀ ਉਹਨਾਂ ਦੀ ਪੋਸ਼ਾਕ ਹੁੰਦੀ ਹੈ ਜਿਸ ਨਾਲ ਉਹ ਅਲੱਗ ਦਿਖਦੇ ਹਨ ਅਤੇ ਸਟੇਜ ਦੇ ਉੱਤੇ ਚੜ ਕੇ ਬਹੁਤ ਹੀ ਵਧੀਆ ਭੰਗੜਾ ਕਰਦੇ ਹਨ